ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ

ਹਾਂਜੀ ਹਾਂਜੀ ਠੀਕ ਹੈ ਜ਼ਰੂਰ ਹਾਂਜੀ ਹਾਂਜੀ ਕਿੰਨੀ ਤਰੀਕ ਹੈ ਠੀਕ ਹੈ ਇਹ ਤਰੀਕ ਕਿੰਨੀ ਹੈ ਕਦੋਂ ਪ੍ਰੋਗਰਾਮ ਹੈ ਤਰੀਕ ਕਿੰਨੀ ਹੈ ਭਾਅ ਜੀ ਪੰਜ ਮਾਰਚ ਠੀਕ ਹੈ ਅੱਛਾ ਕਿੰਨੇ ਦਿਨ ਦਾ ਪ੍ਰੋਗਰਾਮ ਆ ਨਹੀਂ ਤਿੰਨ ਦਿਨ ਦਾ ਹੈ ਨਾ ਜਾਗੋ ਵੀ ਹੈਗੀ ਆ ਅੱਛਾ ਜੀ ਠੀਕ ਹੈ ਦੇਖੋ ਫੋਟੋਆਂ ਦਾ ਲੱਗੂਗਾ ਵੀਹ ਹਜ਼ਾਰ ਰੁਪਇਆ ਅਤੇ ਵੀਡੀਓ ਦਾ ਦਸ ਯਾਨੀ ਕਿ ਤੁਸੀਂ ਮੰਨ ਕੇ ਚੱਲੋ ਚਾਲੀ ਕੁ ਹਜ਼ਾਰ 'ਚ ਕੰਮ ਹੋ ਜੂ ਸਾਰਾ ਠੀਕ ਹੈ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਓਕੇ ਜੀ ਓਕੇ ਵੈਲਕਮ